ਸਰਕਾਰੀ ਸਕੀਮ ਅਧੀਨ ਲੋਕਾਂ ਨੂੰ ਬਹੁਤ ਫੈਸਿਲਿਟੀਜ਼ ਦਿੱਤੀਆਂ ਜਾਂਦੀਆਂ ਹਨ ਸਰਕਾਰ ਨੇ ਆਮ ਜਨਤਾ ਲਈ ਕਾਰਡ ਬਣਾਇਆ ਹੈ ਜਿਸ ਵਿੱਚ ਪੰਜ ਲੱਖ ਤੱਕ ਦਾ ਇਲਾਜ ਫਰੀ ਹੈ ਜਿਸ ਦੇ ਪੈਸੇ ਸਰਕਾਰ ਵੱਲੋਂ ਦਿੱਤੇ ਜਾਂਦੇ ਹਨ ਸਰਕਾਰ ਲੋਕਾਂ ਲਈ ਕੈਂਪ ਲਗਾਉਂਦੀ ਹੈ ਕੈਂਪ ਵਿੱਚ ਘੱਟ ਤੋਂ ਘੱਟ ਦਵਾਈ ਰੇਟ 'ਤੇ ਰ ਦਵਾਈਆਂ ਅਤੇ ਫਰੀ ਟੈਸਟ ਹੁੰਦੇ ਹਨ ਮੈਂ ਸਰਕਾਰੀ ਹਸਪਤਾਲਾਂ ਜਾਣਾ ਪਸੰਦ ਕਰਦੀ ਹਾਂ ਕਿਉਂਕਿ ਉੱਥੇ ਸੇਵਾਵਾਂ ਵਧੀਆਂ ਹੁੰਦੀਆਂ ਹਨ ਦਵਾਈਆਂ ਸਸਤੀਆਂ ਹੁੰਦੀਆਂ ਹਨ ਪਰ ਪ੍ਰਾਈਵੇਟ ਹਸਪਤਾਲਾਂ ਵਿੱਚ ਵਧੀਆਂ ਹੁੰਦੀਆਂ ਹਨ ਉੱਥੇ ਸਫਾਈ ਵੀ ਬਹੁਤ ਹੁੰਦੀ ਹੈ ਸਰਕਾਰੀ ਅਤੇ ਪ੍ਰਾਈਵੇਟ ਹੋਸਪਿਟਲ ਵਿੱਚ ਬਹੁਤ ਫਰਕ ਹੁੰਦਾ ਹੈ ਸਰਕਾਰੀ ਹੋਸਪੀਟਲਾਂ ਵਿੱਚ ਪੈਸੇ ਘੱਟ ਲੱਗਦੇ ਹਨ ਅਤੇ ਦਵਾਈਆਂ ਵੀ ਬਹੁਤ ਸਸਤੀਆਂ ਮਿਲਦੀਆਂ ਹਨ ਅਤੇ ਇਲਾਜ ਕਰਨ ਲਈ ਡਾਕਟਰ ਵੀ ਬਹੁਤ ਵਧੀਆ ਤੋਂ ਵਧੀਆ ਹੁੰਦੇ ਹਨ ਅਤੇ ਉਵੇਂ ਪ੍ਰਾਈਵੇਟ ਹੋਸਪਿਟਲ ਵਿੱਚ ਡਾਕਟਰ ਤਾਂ ਵਧੀਆ ਹੁੰਦੇ ਲੇਕਿਨ ਪੈਸ ਦਵਾਈਆਂ ਬਹੁਤ ਮਹਿੰਗੀਆਂ ਮਿਲਦੀਆਂ ਹਨ ਅਤੇ ਡਾਕਟਰ ਬਹੁਤ ਹੀ ਸਿਰਫ ਦੇਖਣ ਦੇ ਹੀ ਬਹੁਤ ਪੈਸੇ ਲੈਂਦੇ ਹਨ ਜਦ ਲੇਕਿਨ ਪ੍ਰਾਈਵੇਟ ਹੋਸਪਿਟਲ ਕਲੀਨ ਹੁੰਦੇ ਹਨ ਅਤੇ ਉੱਥੇ ਦੇ ਸਟਾਫ ਵੀ ਬਹੁਤ ਵਧੀਆ ਹੁੰਦੇ ਹਨ ਜਿਹੜੇ ਪੇਸ਼ੈਂਟਸ ਦੀ ਬਹੁਤ ਕੇਅਰ ਕਰਦੇ ਹਨ ਅਤੇ ਪੇਸ਼ੈਂਟਸ ਨੂੰ ਬਹੁਤ ਵਧੀਆ ਟਰੀਟ ਕਰਦੇ ਹਨ ਅਤੇ ਉੱਥੇ ਬਹੁਤ ਹੀ ਸ਼ਾਂਤੀ ਹੁੰਦੀ ਹੈ ਅਤੇ ਉੱਥੇ ਕਰਾਊਡ ਨੂੰ ਵੀ ਪੂਰੀ ਤਰ੍ਹਾਂ ਮੇਨਟੇਨ ਕੀਤਾ ਜਾਂਦਾ ਹੈ ਅਤੇ ਪ੍ਰਾ ਗ ਪ੍ਰਾਈਵੇਟ ਹੋਸਪਿਟਲਾਂ ਵਿੱਚ ਐਮਰਜੈਂਸੀ ਵਾਰਡ ਵੀ ਬਹੁਤ ਵਧੀਆ ਹਨ ਜਿੱਥੇ ਪੇਸ਼ੈਂਟਸ ਨੂੰ ਈਜ਼ੀਲੀ ਮਿਲ ਸਕ ਟਰੀਟਮੈਂਟ ਮਿਲਦਾ ਹੈ